ਹਾਂ ਔਰਤਾਂ ਖੇਡਾਂ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਬਹੁਤ ਸਾਰੀਆਂ ਔਰਤਾਂ ਜਾ ਨੂੰ ਜਾਣਦੀਆਂ ਜਿਹੜੀਆਂ ਕਈ ਤਾਂ ਵਰਡ ਫੇਮਸ ਨੇ ਜਿਵੇਂ ਸਾਨੀਆ ਮਿਰਜ਼ਾ ਹੋ ਗਈ ਟੇਬਲ ਟੈਨਿਸ ਦੇ ਵਿੱਚ ਸਾਨੀਆ ਨੇਹਵਾਲ ਹੋ ਗਈ ਐਵੇਂ ਹੀ ਬੋਕਸਿੰਗ ਦੇ ਵਿੱਚ ਨੇ ਜਿਮਨਾਸਟਿਕ ਦੇ ਵਿੱਚ ਨੇ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਖੇਡਦੀਆਂ ਨੇ ਭਾਰਤ ਦੇ ਵਿੱਚ ਵੀ ਔਰਤਾਂ ਲਈ ਕਾਫੀ ਮੌਕੇ ਉਪਲਬਧ ਨੇ ਜਿਵੇਂ ਉਹਨਾਂ ਨੂੰ ਵੀ ਖੇਡਣ ਦਾ ਪੂਰਾ ਮਾਣ ਮਿਲਿਆ ਹੋਇਆ ਖੇਡ ਸਕਦੀਆਂ ਨੇ ਸ਼ੁਰੂ ਤੋਂ ਹੀ ਸਿੱਖਣਾ ਸ਼ੁਰੂ ਕਰ ਦਿੰਦੀਆਂ ਨੇ ਬੈਡਮਿੰਟਨ ਦੇ ਵਿੱਚ ਬੜੀਆਂ ਅੱਗੇ ਜਾ ਚੁੱਕੀਆਂ ਨੇ ਹੋਕੀ ਦੇ ਵਿੱਚ ਵੀ ਜੇ ਅੱਗੇ ਚੱਲਦੀਆਂ ਨੇ ਹੁਣ ਤਾਂ ਕ੍ਰਿਕਟ ਵੀ ਖੇਡਣ ਲੱਗ ਗਈਆਂ ਨੇ ਵਧੀਆ ਮੌਕੇ ਮਿਲਦੇ ਇਹਨਾਂ ਨੂੰ ਵੀ ਖੇਡਣ ਦੇ ਆਪਣੇ ਆਪ ਨੂੰ ਪੇਸ਼ ਕਰਨ ਦੇ